ਹੈਲੋ ਹ ਹਾਂਜੀ ਹਾਂਜੀ ਬਾਣੀ ਡੈਅਰੀ ਪਟਿਆਲਾ ਤੋਂ ਬੋਲ ਰਹੇ ਹਾਂ ਹੈਡ ਆਫਿਸ ਆਪਣੇ ਕੋਲ ਗੋਕਾ ਵੀ ਹੁੰਦਾ ਹੈਗਾ ਹਾਂਜੀ ਅਤੇ ਮੱਝ ਦਾ ਦੁੱਧ ਵੀ ਮਿਲ ਜਾਂਦਾ ਤੁਹਾਨੂੰ ਕਿਹੜੀ ਕੁਆਲਿਟੀ ਦਾ ਦੁੱਧ ਚਾਹੀਦਾ ਏ ਗ੍ਰੇਡ ਬੀ ਗ੍ਰੇਡ ਠੀਕ ਹੈ ਤੁਸੀਂ ਨਾ ਨਾ ਨਾ ਤੁਹਾਨੂੰ ਜਿਹੜਾ ਦੁੱਧ ਬਿਲਕੁਲ ਸਹੀ ਮਿਲੇਗਾ ਹਾਂ ਹਾਂ ਹਾਂ ਤੁਹਾਨੂੰ ਫੈਂਟ ਵਾਲਾ ਦੁੱਧ ਮਿਲੇਗਾ ਅੱਠ ਪੰਜ ਨੌ ਤਿੰਨ ਦੇ ਕਰੀਬ ਤੁਹਾਨੂੰ ਜਿਹੜਾ ਐਸ ਐਮ ਐਫ ਦੇ ਵਿੱਚ ਮਿਲ ਜੂਗਾ ਤੁਸੀਂ ਯੂਜ ਐਕਚੁਲੀ ਕਿਸ ਲਈ ਕਰਨਾ ਹੈਗਾ ਕੋਈ ਮੈਰਜ ਵਗੈਰਾ ਜਾਂ ਤੁਹਾਡਾ ਹਲਵਾਈ ਦਾ ਕੰਮ ਆ ਠੀਕ ਹੈ ਤੁਹਾਨੂੰ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਦੁੱਧ ਦੇਵਾਂਗੇ ਜਿਹਦੇ ਵਿੱਚ ਤੁਸੀਂ ਆਪਣਾ ਜਿਹੜਾ ਆਈਸ ਕ੍ਰੀਮ ਵੀ ਬਣਾ ਸਕੋਂਗੇ ਆਪਦੀ ਦਹੀਂ ਵੀ ਤੁਸੀਂ ਵਧੀਆ ਬਣਾ ਸਕੋਂਗੇ ਹਾਂ ਮਠਿਆਈ ਬਣਾਉਣੀ ਹੈ ਤੁਸੀਂ ਤਾਂ ਮਠਿਆਈ ਦੇ ਲਈ ਵੀ ਯੂਜ ਕਰ ਸਕੋਗੇ ਤੁਹਾਨੂੰ ਬੈਸਟ ਕੁਆਲਿਟੀ ਦੇ ਵਿੱਚ ਜਿਹੜਾ ਬੀ ਗ੍ਰੇਡ ਦੇ ਵਿੱਚ ਵੀ ਬੈਸਟ ਕੁਆਲਿਟੀ ਜਿਹੜਾ ਅਸੀਂ ਮਿਲਕ ਦੇ ਸਕਾਂਗੇ ਹਾਂ ਪਰ ਹਾਂਜੀ ਹਾਂਜੀ ਹਾਂਜੀ ਤੁਹਾਨੂੰ ਜਿਹੜਾ ਹੈਗਾ ਅਸੀਂ ਪਹੁੰਚ ਵੀ ਕਰਕੇ ਦੇਵਾਂਗੇ ਕਿੰਨੇ ਕਿਲੋਮੀਟਰ ਹੈ ਤੁਸੀਂ ਆਪਣਾ ਐਡਰੈਸ ਵਗੈਰਾ ਸਾਨੂੰ ਭੇਜਣਾ ਹੈਗਾ ਤੁਹਾਡੇ ਫਿਰ ਐਡਰੈਸ 'ਤੇ ਜਿਹੜਾ ਪਹੁੰਚ ਜਾਊਗਾ ਤੁਹਾਨੂੰ ਪ੍ਰ ਪ੍ਰੰਤੂ ਜਿਹੜੀ ਪੇਮੈਂਟ ਐਡਵਾਂਸ ਵਿੱਚ ਕਰਨੀ ਪੈਣੀ ਹੈ ਕਿਹੜੀ ਡੇਟ ਨੂੰ ਤੁਸੀਂ ਲੈਣਾ ਕਿੰਨਾ ਲੈਣਾ ਹੈਗਾ ਉਹਦੇ ਵਿੱਚ ਤੁਹਾਨੂੰ ਪੇਮੈਂਟ ਜਿਹੜੀ ਐਡਵਾਂਸ ਕਰਨੀ ਪੈਣੀ ਹੈ ਪੇਮੈਂਟ ਜਿਹੜੀ ਹੈ ਹੰਡਰਡ ਪਰਸੈਂਟ ਐਡਵਾਂਸ ਹੋਊਗੀ ਪੂਰੀ ਦੀ ਪੂਰੀ ਪੇਮੈਂਟ ਦੁੱਧ ਤੁਹਾਨੂੰ ਜਿਹੜਾ ਬੀ ਗ੍ਰੇਡ ਦੇ ਵਿੱਚ ਵੀ ਉੱਤਮ ਕੁਆਲਿਟੀ ਦਾ ਮਿਲੇਗਾ ਜਿਹੜਾ ਤੁਸੀਂ ਕਿਸੇ ਹੋਰ ਵੀ ਡੈਅਰੀ ਤੋਂ ਵੇਰਕਾ ਵਗੈਰਾ ਜਾਂ ਤੁਹਾਡੇ ਹੋਰ ਵੀ ਕੋਈ ਡੈਅਰੀ ਆਉਂਦੀ ਹੈ ਉਸ ਤੋਂ ਨਹੀਂ ਪ੍ਰਾਪਤ ਹੋਊਗਾ ਹਾਂ ਉਹ ਤੁਹਾਨੂੰ ਉੱਥੋਂ ਕੁਆਲਿਟੀ ਨਹੀਂ ਮਿਲੇਗੀ ਜਿਹੜੀ ਕੁਆਲਟੀ ਸਾਡੇ ਕੋਲੋਂ ਮਿਲਣੀ ਹੈ ਹਾਂਜੀ ਮੱਝ ਦਾ ਦੁੱਧ ਅਤੇ ਕਿੰਨੇ ਤੁਹਾਨੂੰ ਚਾਹੀਦਾ ਹੈਗਾ ਦੋ ਦਿਨ ਦੇ ਲਈ ਚਾਹੀਦਾ ਜਾਂ ਤਿੰਨ ਦਿਨ ਦੇ ਲਈ ਤੁਹਾਨੂੰ ਚਾਹੀਦਾ ਹਾਂ ਹਾਂ ਤਿੰਨ ਦਿਨ ਲਈ ਮਿਲ ਜਾਵੇਗਾ ਤਦ ਤੁਹਾਨੂੰ ਡੇ ਬਾਏ ਡੇ ਅਸੀਂ ਜਿਹੜਾ ਪਹੁੰਚ ਕਰਾਂਗੇ ਇੱਕੋ ਦਿਨ ਨਹੀਂ ਤਿੰਨਾਂ ਦਿਨਾਂ ਦਾ ਦੇਵਾਂਗੇ ਤਾਂ ਕਿ ਜਿਹੜਾ ਤੁਹਾਨੂੰ ਹਰ ਡੇ ਦੇ ਲਈ ਅਸੀਂ ਅਲੱਗ ਤੋਂ ਜਿਹੜਾ ਦੁੱਧ ਦੇਵਾਂਗੇ ਕਿਉਂਕਿ ਤੁਹਾਡੀ ਉਹਦੀ ਕੁਆਲਿਟੀ ਨਾ ਖਰਾਬ ਹੋਏ ਹਾਂ ਫਰੈਸ਼ ਹੋਊਗਾ ਕੁਆਲਿਟੀ ਨਾ ਖਰਾਬ ਹੋਵੇ ਉਹਦੇ ਲਈ ਤੁਹਾਨੂੰ ਜਿਹੜਾ ਇੱਕ ਤਾਂ ਸਾਨੂੰ ਕੁਆਂਟਿਟੀ ਦੱਸੋ ਤੁਹਾਨੂੰ ਕਿੰਨੀ ਚਾਹੀਦੀ ਹੈ ਲਗਭਗ ਕੁਆਂਟਿਟੀ ਦੇ ਦਿਓ ਬਾਕੀ ਤੁਸੀਂ ਜਿਹੜੀ ਕੁਆਂਟਿਟੀ ਆ ਸਾਨੂੰ ਲਿਖਤੀ ਰੂਪ ਵਿੱਚ ਦਿਓਗੇ ਠੀਕ ਆ ਜਾਣੀ ਕਿ ਠੀਕ ਠੀਕ ਕੋਈ ਗੱਲ ਨਹੀਂ ਮਿਲ ਜਾਵੇਗਾ ਵੈਸੇ ਘੱਟ ਆ ਤੁਹਾਨੂੰ ਜ਼ਿਆਦਾ ਨਹੀਂ ਚਾਹੀਦਾ ਗਾ ਮੈਰਿਜ ਲਈ ਤਾਂ ਬਹੁਤ ਜ਼ਿਆਦਾ ਲੱਗ ਜਾਂਦਾ ਠੀਕ ਠੀਕ ਠੀਕ ਠੀਕ ਠੀਕ ਹੈ ਤੁਸੀਂ ਇੱਕ ਵਾਰੀ ਯੂਜ ਕਰੋਗੇ ਤਾਂ ਤੁਸੀਂ ਫਿਰ ਵੀ ਜਿਹੜਾ ਹੈਗਾ ਮੰਗ ਕਰੋਗੇ ਇਸ ਚੀਜ਼ ਦੀ ਚਲੋ ਤੁਸੀਂ ਸਾਨੂੰ ਆਪਣਾ ਜਿਹੜਾ ਐਡਰੈਸ ਆ ਜਿਹੜਾ ਉਹ ਸੈਂਡ ਕਰ ਦੇਣਾ ਅਤੇ ਆਪਣੀ ਜਿਹੜੀ ਪੇਮੈਂਟ ਤੁਸੀਂ ਜਿਹੜੀ ਹੈਗੀ ਆ ਆਨਲਾਈਨ ਵੀ ਕਰ ਸਕਦੇ ਹੋ ਜੇ ਤੁਸੀਂ ਸਾਡੇ ਦਫਤਰ ਆਉਣਾ ਤਾਂ ਦਫਤਰ ਵਿੱਚ ਵੀ ਆ ਸਕਦੇ ਹੋ ਹਾਂਜੀ ਹਾਂਜੀ ਹਾਂਜੀ ਜਿਹੜਾ ਤੁਸੀਂ ਸਮਾਂ ਦਿਓਗੇ ਉਸ ਸਮੇਂ 'ਤੇ ਪਹੁੰਚ ਜਾਵੇਗਾ ਠੀਕ ਹੈ ਜੀ ਓਕੇ ਜੀ